ਮੈਂ ਪਹਾੜਾਂ ਵਿੱਚ ਜਾਣਾ ਪਸੰਦ ਕਰਦੀ ਹਾਂ ਅਤੇ ਮੰਦਰ ਧਾਰਮਿਕ ਅਸਥਾਨਾਂ ਵਿੱਚ ਅਤੇ ਰਿਸ਼ਤੇਦਾਰਾਂ ਦੇ ਘਰ ਜਾਣਾ ਪਸੰਦ ਕਰਦੀ ਹਾਂ ਕਿਉਂਕਿ ਪਹਾੜਾਂ ਦਾ ਮੌਸਮ ਬਹੁਤ ਵਧੀਆ ਹੁੰਦਾ ਪਹਾੜਾਂ 'ਤੇ ਜਾ ਕੇ ਸਾਨੂੰ ਬਹੁਤ ਆਨੰਦ ਮਿਲਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਇਤਿਹਾਸਿਕ ਸਥਾਨ 'ਤੇ ਜਾ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਉੱਥੇ ਸਾਨੂੰ ਬਹੁਤ ਹੀ ਚੰਗੀ ਸਿੱਖਿਆ ਮਿਲਦੀ ਹੈ ਇਤਿਹਾਸਿਕ ਜਗ੍ਹਾ 'ਤੇ ਜਾ ਕੇ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਉੱਥੇ ਜਾ ਕੇ ਸਾਡਾ ਬਹੁਤ ਜੀ ਲੱਗਦਾ ਹੈ ਧਾਰਮਿਕ ਅਸਥਾਨ ਸਾਡੇ ਲਈ ਬਹੁਤ ਚੰਗੇ ਹੁੰਦੇ ਹਨ ਕਿਉਂਕਿ ਉਹ ਸਾਨੂੰ ਬਹੁਤ ਚੰਗੀ ਸਿੱਖਿਆ ਦਿੰਦੇ ਹਨ ਰਿਸ਼ਤੇਦਾਰਾਂ ਦੇ ਘਰ ਜਾ ਕੇ ਵੀ ਸਾਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਰਿਸ਼ਤੇਦਾਰਾਂ ਦੇ ਘਰ ਜਾ ਕੇ ਅਸੀਂ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਾਂ ਉੱਥੇ ਸਾਡਾ ਬਹੁਤ ਚੰਗਾ ਮਨੋਰੰਜਨ ਹੁੰਦਾ ਹੈ ਸਾਡੇ ਬੱਚਿਆਂ ਦਾ ਵੀ ਬਹੁਤ ਵਧੀਆ ਮਨੋਰੰਜਨ ਹੁੰਦਾ ਹੈ ਰਿਸ਼ਤੇਦਾਰਾਂ ਦੇ ਘਰ ਜਾ ਕੇ ਸਾਨੂੰ ਵਧੀਆ ਲੱਗਦਾ ਹੈ ਕਿਉਂਕਿ ਰਿਸ਼ਤੇਦਾਰ ਹੀ ਸਾਡੇ ਪਰਿਵਾਰ ਵਾਂਗ ਹੀ ਸਾਡਾ ਖਿਆਲ ਰੱਖਦੇ ਹਨ ਥੈਂਕ